ਪਿਛਲੇ ਕਾਫੀ ਦਹਾਕਿਆਂ ਤੋਂ ਕਹਿ ਲਉ ਜਾਂ ਪੂਰੀ ਇੱਕ ਸਦੀ ਦੌਰਾਨ ਜੋ ਵੱਖ ਵੱਖ ਤਰ੍ਹਾਂ ਦੇ ਇਸ਼ਤਿਹਾਰ ਦਿੱਤੇ ਜਾਂਦੇ ਹਨ ਜੋ ਕਿ ਵੱਖ ਵੱਖ ਜੋ ਪ੍ਰੋਡਕਟ ਨੇ ਉਹਨਾਂ ਦੀ ਮਸ਼ਹੂਰੀ ਦੇ ਲਈ ਜਿਹੜਾ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ ਉਹਨਾਂ ਦੇ ਵਿੱਚ ਜਿਹੜਾ ਹੈ ਉਹ ਟੈਲੀਵਿਜ਼ਨ ਦੇ ਉੱਤੇ ਅਖਬਾਰਾਂ ਰਾਹੀਂ ਵੱਖ ਵੱਖ ਤਰ੍ਹਾਂ ਦੇ ਵੱਖ ਵੱਖ ਕਿਸਮ ਦੇ ਇਸ਼ਤਿਹਾਰਾਂ ਦੀ ਵਰਤੋਂ ਹੁੰਦੀ ਰਹਿੰਦੀ ਹੈ ਉਹਨਾਂ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਬਹੁਤ ਹੀ ਰੋਚਕ ਤਰੀਕੇ ਦੇ ਨਾਲ ਇੱਕ ਇਹ ਇਸ਼ਤਿਹਾਰ ਪ੍ਰਚਲਿਤ ਹੋਇਆ ਸੀ ਜਿਸ ਦੇ ਵਿੱਚ ਜੋ ਕੱਪੜੇ ਧੋਣ ਵਾਲੇ ਪਾਊਡਰ ਦੀ ਜੋ ਵਿਸ਼ੇਸ਼ਤਾਵਾਂ ਨੂੰ ਉਘਾੜਨ ਦੇ ਲਈ ਉਹ ਇਸ਼ਤਿਹਾਰ ਦਿੱਤਾ ਗਿਆ ਸੀ ਅਤੇ ਉਸ ਦੀ ਵਰਤੋਂ ਦੇ ਨਾਲ ਜੋ ਉਹ ਕੱਪੜੇ ਧੋਣ ਵਾਲਾ ਪਾਊਡਰ ਹੈ ਉਹਦੀ ਵਿਕਰੀ ਦੇ ਵਿੱਚ ਵਾਧਾ ਹੋਇਆ ਸੀ ਅਤੇ ਬਹੁਤ ਹੀ ਰੋਚਕ ਤਰੀਕੇ ਦੇ ਨਾਲ ਉਹਦੀ ਮਸ਼ਹੂਰੀ ਕੀਤੀ ਗਈ ਸੀ